ਮੈਨੂੰ ਸਮਝ ਨਹੀਂ ਆ ਰਹੀ ਕਿ ਨਵੇਂ ਕੈਮਰੇ ਲਈ ਬਾਜ਼ਾਰ ਵਿੱਚ ਕਿੱਥੋਂ ਸ਼ੁਰੂ ਕਰਾਂ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਮੈਨੂੰ ਕੁਦਰਤੀ ਚੀਜ਼ਾਂ ਦੀ ਫੋਟੋਗ੍ਰਾਫੀ ਕਰਨੀ ਵਧੀਆ ਲੱਗਦੀ ਹੈ ਇਸ ਕਰਕੇ ਮੈਂ ਇੱਕ ਵਧੀਆ ਕੁਆਲਿਟੀ ਦਾ ਕੈਮਰਾ ਖਰੀਦਣਾ ਚਾਹੁੰਦੀ ਹਾਂ ਤਾਂ ਜੋ ਮੈਂ ਆਪਣਾ ਸ਼ੌਂਕ ਪੂਰਾ ਕਰ ਸਕਾਂ ਜਿਹੜਾ ਕਿ ਮੇਰੇ ਬਜਟ ਦੇ ਅਨੁਸਾਰ ਹੋਵੇ ਅਤੇ ਫੋਟੋਗ੍ਰਾਫੀ ਦੀ ਜ਼ਰੂਰਤਾਂ ਦੇ ਆਧਾਰ 'ਤੇ ਸਰਵੋਤਮ ਕੈਮਰਾ ਖਰੀਦਣਾ ਚਾਹੁੰਦੀ ਹਾਂ ਤੁਸੀਂ ਮੈਨੂੰ ਲੇਟੈਸਟ ਕੈਮਰਾ ਖਰੀਦਣ ਦਾ ਸੁਝਾਅ ਦਿਓ ਤਾਂ ਜੋ ਮੈਂ ਆਪਣਾ ਸ਼ੌਂਕ ਪੂਰਾ ਕਰ ਸਕਾਂ